ਅਠਾਈ ਸਤੰਬਰ ਉੱਨੀ ਸੌ ਛਿਆਨਵੇਂ ਇੱਕ ਮਈ ਦੋ ਹਜ਼ਾਰ ਦੋ ਇਕੱਤੀ ਅਗਸਤ ਉੱਨੀ ਸੌ ਨੜਿਨਵੇਂ ਤੀਹ ਜੂਨ ਦੋ ਹਜ਼ਾਰ ਤੇਈ ਉੱਨੀ ਜਨਵਰੀ ਉੱਨੀ ਸੌ ਨੌ